ਸਤਿ ਸ਼੍ਰੀ ਅਕਾਲ ਮੇਰਾ ਨਾਮ ਲਖਬੀਰ ਸਿੰਘ ਹੈ ਜੀ ਮੈਂ ਸੈਂਟਰ ਯੂਨੀਵਰਸਿਟੀ ਪੰਜਾਬ ਕੁੱਕ ਦਾ ਕੰਮ ਕਰਦਾ ਜੀ ਅਤੇ ਇਹਦੇ ਵਿੱਚ ਮਤਲਬ ਸਬਜ਼ੀਆਂ ਸਾਰੀਆਂ ਬਣਾ ਲੈਂਦਾ ਜੀ ਜਿਵੇਂ ਸ਼ਾਹੀ ਪਨੀਰ ਹੋ ਗਿਆ ਦਾਲ ਹੋ ਗਈ ਰਾਜਮਾਂਹ ਹੋ ਗਏ ਮੂੰਗੀ ਮਸਰੀ ਹੋ ਗਈ ਅਤੇ ਪੇਠੇ ਦੀ ਸਬਜ਼ੀ ਹੋ ਗਈ ਅਤੇ ਆਪਣਾ ਸੁੱਕੀ ਗੋਭੀ ਹੋ ਗਈ ਅਤੇ ਪਹਾੜੀ ਪਹਾੜੀ ਮਿਰਚ ਹੋ ਗਈ ਸ਼ਾਹੀ ਪਨੀਰ ਹੋ ਗਿਆ ਜੀ ਅਤੇ ਸ਼ਾਹੀ ਪਨੀਰ ਸਰ ਅ ਸਾਰੇ ਅ ਮੈਨੂੰ ਵੀ ਬਹੁਤ ਵਧੀਆ ਲੱਗਦਾ ਬਣਾਉਣਾ ਅਤੇ ਸਾਰੇ ਹੀ ਬਹੁਤ ਸ਼ੌਂਕ ਨਾਲ ਖਾਂਦੇ ਆ ਸ਼ਾਹੀ ਪਨੀਰ ਅਤੇ ਸਾਰਿਆਂ ਦੀ ਪਸੰਦ ਹੈ ਅਤੇ ਉਤੋਂ ਇੱਥੇ ਬਣਦਾ ਹੈਗਾ ਖਾਂਦੇ ਆ ਅਤੇ ਲੋਕ ਬਹੁਤ ਜ਼ਿਆਦਾ ਤਰੀਫ ਕਰਦੇ ਆ ਵੀ ਬਹੁਤ ਵਧੀਆ ਬਣਦਾ ਸ਼ਾਹੀ ਪਨੀਰ ਅਤੇ ਸਤਿ ਸ਼੍ਰੀ ਅਕਾਲ ਜੀ